ਸਿਲਾਈ ਸਿਲਾ ਸਿਲਾਈ ਬਣਾਈ ਦਾ ਪੈਟਰਨ ਕੁਝ ਵਿਲੱਖਣ ਤਕਨੀਕਾਂ ਬਾਰੇ ਦੱਸੋ ਕੀ ਤੁਸੀਂ ਵਿਰਾਇਤੀ ਕੱਪੜੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਮੈਂ ਬਹੁਤ ਸਿਲਾਈ ਕੀਤੀ ਹੈ ਪਰ ਮੈਨੂੰ ਸਿਲਾਈ ਦਾ ਬਹੁਤ ਸ਼ੌਂਕ ਹੈ ਇਸ ਲਈ ਮੈਂ ਸਿਲਾਈ ਦਾ ਕੰਮ ਬਹੁਤ ਚਿਰ ਕੀਤਾ ਹੈ ਪਰ ਮੈਂ ਜੋ ਵੀ ਕੀਤਾ ਪੰਜਾਬੀ ਸੱਭਿਆਚਾਰ ਦੇ ਸੂਟ ਹੀ ਬਣਾਏ ਹਨ ਅਤੇ ਇਸ ਲਈ ਮੈਂ ਹੁਣ ਵੀ ਕਦੇ ਕਦੇ ਸ਼ੌਂਕ ਜਾਗਦਾ ਹੈ ਤਾਂ ਮੈਂ ਪੰਜਾਬੀ ਸੱਭਿਆਚਾਰ ਦੇ ਸੂਟ ਹੀ ਬਣਾਉਣਾ ਪਸੰਦ ਕਰਦੀ ਹਾਂ ਅਤੇ ਸਿਲਾਈ ਵਿੱਚ ਵੀ ਮੈਨੂੰ ਬਹੁਤ ਸ਼ੌਂਕ ਹੈ ਸਿਲਾਈ ਦਾ ਕੰਮ ਤਾਂ ਮੈਂ ਅੱਠਵੀਂ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਤੱਕ ਮੇਰਾ ਸਿਲਾਈ ਦਾ ਕੰਮ ਚੱਲਦਾ ਹੈ ਅਤੇ ਜੋ ਬੁਣਾਈ ਦਾ ਕੰਮ ਉਹ ਵੀ ਮੈਨੂੰ ਬਹੁਤ ਸ਼ੌਂਕ ਹੈ ਉਹ ਵੀ ਮੇਰਾ ਅੱਠਵੀਂ ਵਿੱਚ ਹੀ ਸ਼ੁਰੂ ਕੀਤਾ ਹੋਇਆ ਹੈ ਕੋਈ ਵੀ ਬੁਣਤੀ ਪਵਾਉਣਾ ਕੋਈ ਸਿਲਾਈਆਂ 'ਤੇ ਸੂਐਟਰ ਬੁਣਨਾ ਕੋਈ ਕੋਟੀ ਬੁਣਨੀ ਕੁਛ ਵੀ ਕਰਨਾ ਬੱਚਿਆਂ ਦੇ ਕੱਪੜੇ ਬਣਾਉਣਾ ਕੋਟੀਆਂ ਸੁਐਟਰ ਬਣਾਉਣਾ ਮੈਨੂੰ ਬਹੁਤ ਸ਼ੌਂਕ ਹੈ ਅਤੇ ਹੁਣ ਤੱਕ ਵੀ ਮੈਨੂੰ ਪੂਰਾ ਸ਼ੌਂਕ ਰਹਿੰਦਾ ਹੈ ਕੋਈ ਵੀ ਬੁਣਤੀ ਹੁੰਦੀ ਫਟਾਫਟ ਮੈਂ ਲਾਹ ਕੇ ਰੱਖਣ ਦੀ ਤਿਆਰੀ ਕਰਦੀ ਹਾਂ ਕਿਸੇ ਦਾ ਸੂਟ ਦੇ ਗਲੇ ਦਾ ਡਿਜਾਈਨ ਵੇਖ ਲਵਾਂ ਸੂਟ 'ਤੇ ਕੋਈ ਡਿਜੈਨ ਪਾਇਆ ਦੇਖ ਲਾਂ ਮੈਂ ਆਕੇ ਉਸਨੂੰ ਤਿਆਰ ਕਰਦੀ ਹਾਂ ਅਤੇ ਇਸ ਲਈ ਮੈਨੂੰ ਸਿਲਾਈ ਬਣਾਈ ਵਿੱਚ ਬਚਪਨ ਤੋਂ ਹੀ ਸ਼ੌਂਕ ਹੈ ਕਿਉਂਕਿ ਮੇਰੇ ਪਰਿਵਾਰ ਵਿੱਚ ਮੇਰੇ ਮਾਤਾ ਜੀ ਏਹੀ ਕੰਮ ਕਰਦੇ ਸਨ ਅਤੇ ਸਾਡਾ ਸ਼ੌਂਕ ਬਣਿਆ ਹੋਇਆ ਹੈ ਅਤੇ ਹੁਣ ਵੀ ਮੈਂ ਸਿਲਾਈ ਕਢਾਈ ਦਾ ਕੰਮ ਆਪਦੀ ਖੁਸ਼ੀ ਨਾਲ ਹੀ ਕਰਦੀ ਹਾਂ ਅਤੇ ਮੈਨੂੰ ਹਜੇ ਵੀ ਪੂਰਾ ਸ਼ੌਂਕ ਹੈ ਕਿ ਮੈਂ ਸਿਲਾਈ ਕਢਾਈ ਦਾ ਕਰਦੀ ਰਵਾਂ ਅਤੇ ਕਰਦੀ ਵੀ ਹਾਂ ਕੋਈ ਵੀ ਕੰਮ ਆਪਣੇ ਕੋਟੀ ਸੁਐਟਰ ਬਣਾ ਕੇ ਪਾਉਣਾ ਤਾਂ ਮੈਂ ਆਪ ਪਾਉਂਦੀ ਹਾਂ ਆਪਣਾ ਆਪ ਬਣਾਉਂਦੀ ਹਾਂ ਅਤੇ ਸੂਟ ਵੀ ਮੈਂ ਆਪਣੇ ਆਪ ਸਿਓਂ ਕੇ ਪਾਉਂਦੀ ਹਾਂ